ਪੰਜਾਬ ਵਿੱਚ ਕਲਾ ਅਤੇ ਸ਼ਿਲਪਕਾਰੀ ਖੇਤਰ ਦਾ ਸਾਹਮਣਾ ਬਹੁਤ ਸਾਰੀ ਚੁਣੌਤੀਆਂ ਨੂੰ ਕਰਨਾ ਪੈਂਦਾ ਹੈ ਜਿਵੇਂ ਕਿ ਉਹਨਾਂ ਨੂੰ ਉੰਨੀ ਫੰਡਿੰਗ ਨਹੀਂ ਮਿਲਦੀ ਹੈ ਉਹਨਾਂ ਦੀ ਉੰਨੀ ਮਾਨਤਾ ਨਹੀਂ ਹੈਗੀ ਆ ਅਤੇ ਜਿਵੇਂ ਉਹਨਾਂ ਦੀ ਬਣਾਈ ਬਹੁਤ ਜ਼ਿਆਦਾ ਹੈ ਮਡ ਮਾਰਕੀਟ ਵਿੱਚ ਮੋਡਨ ਚੀਜ਼ਾਂ ਹੋਣ ਦੇ ਕਾਰਨ ਉਹਨਾਂ ਦੀ ਡਿਮਾਂਡ ਉੰਨੀ ਨਹੀਂ ਹੈਗੀ ਅਤੇ ਉਹ ਇੰਨੀਆਂ ਨਹੀਂ ਵਿਕਦੀਆਂ ਕਿਉਂਕਿ ਜੇ ਅਸੀਂ ਕਿਸੇ ਚੀਜ਼ ਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਉਹਦੀ ਖ਼ਰੀਦ ਅਤੇ ਉਹਦੀ ਬਣਵਾਈ ਦੋਵੇਂ ਬਰਾਬਰ ਹੋਣੀ ਚਾਹੀਦੀਆਂ ਨੇ ਪਰ ਇਹਦੇ ਵਿੱਚ ਕੀ ਹੁੰਦਾ ਹੈ ਕਿ ਉਹਦੀ ਬਣਾਈ ਬਹੁਤ ਜ਼ਿਆਦਾ ਹੁੰਦੀ ਪਈ ਹੈ ਕਈ ਲੋਕ ਲੋਨ ਲੈ ਲੈ ਕੇ ਵੀ ਉਹਨੂੰ ਬਣਵਾਉਂਦੇ ਨੇ ਲੇਕਿਨ ਲੋਕ ਅੱਜ ਕੱਲ੍ਹ ਮੋਡਨ ਜ਼ਮਾਨੇ ਵਿੱਚ ਹੋਣ ਕਾਰਨ ਉਹ ਇੰਨਾ ਨਹੀਂ ਧਿਆਨ ਦਿੰਦੇ ਅਤੇ ਉਹਦੀ ਇੰਨੀ ਖ਼ਰੀਦ ਨਹੀਂ ਹੁੰਦੀ ਦੂਜਾ ਅੱਜ ਕੱਲ੍ਹ ਏ ਆਈ ਦਾ ਜ਼ਮਾਨਾ ਹੈ ਅਤੇ ਮੋਡਨ ਜ਼ਮਾਨੇ ਦੇ ਵਿੱਚ ਵੈਸੇ ਵੀ ਕੋਈ ਇੱਦਾਂ ਦੀ ਕਲਾ ਜਾ ਸ਼ਿਲਪਕਾਰੀ ਵੱਲ ਇੰਨਾਂ ਧਿਆਨ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਸਭ ਕੁਛ ਬਹੁਤ ਨੋਰਮਲੀ ਸਭ ਕੁਛ ਔਨਲਾਈਨ ਮਿਲ ਜਾਂਦਾ ਹੈ ਅਤੇ ਇਸ ਕਰਕੇ ਉਹ ਇੰਨਾ ਉਸ ਚੀਜ਼ ਵਿੱਚ ਨਹੀਂ ਜਾਂਦੇ ਹਨ ਅਤੇ ਲੋਕਾਂ ਦਾ ਇੰਨਾ ਇੰਟਰਸਟ ਵੀ ਨਹੀਂ ਰਿਹਾ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਜੇ ਕੁਛ ਔਨਲਾਈਨ ਚੰਗੀ ਤਰ੍ਹਾਂ ਮਿਲਦਾ ਪਿਆ ਹੈ ਅਤੇ ਉਹ ਪੂਰੀ ਚੰਗੀ ਡੈਕੋਰੇਸ਼ਨ ਅਤੇ ਉਹਦੇ ਵਿੱਚ ਹੈਗਾ ਅਤੇ ਉਹ ਕਿਉਂ ਕਲਾ ਅਤੇ ਸ਼ਿਲਪਕਾਰੀ ਵੱਲ ਜਾਣਗੇ ਉਹ ਕਿਉਂ ਇੱਦਾਂ ਦਾ ਕੁਛ ਕਰਨਗੇ ਜਿਹਦੇ ਵਿੱਚ ਬਹੁਤ ਸਾਰੇ ਬਹੁਤ ਜ਼ਿਆਦਾ ਟਾਈਮ ਲੱਗੇ ਅਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਲੱਗੇ ਉਹ ਦੂਜੇ ਸਾਈਡ ਜਾਣਾ ਜ਼ਿਆਦਾ ਪ੍ਰੈਫਰ ਕਰਦੇ ਨੇ ਤਾਂ ਕਿ ਇਸ ਕਰਕੇ ਲੋਕਾਂ ਦਾ ਇੰਟਰਸਟ ਇਹਨਾਂ ਸ਼ਿਲਪਕਾਰੀਆਂ ਅਤੇ ਕਲਾਂ ਵਿੱਚ ਬਹੁਤ ਘੱਟ ਗਿਆ ਹੈ ਅਤੇ ਪੰਜਾਬ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਇੱਥੇ ਜਿੱਦਾਂ ਦੇ ਇੰਸਟਰੂਮੈਂਟਸ ਪੰਜਾਬ 'ਚ ਬਣਦੇ ਨੇ ਉਹ ਕਿਤੇ ਹੋਰ ਨਹੀਂ ਬਣਦੇ ਇੱਥੋਂ ਦੇ ਲੋਕ ਹੀ ਉਹਨਾਂ ਨੂੰ ਬਣਾ ਸਕਦੇ ਹਨ ਬਟ ਉੰਨੀ ਉਹਨਾਂ ਦੀ ਨਾ ਖ਼ਰੀਦ ਹੈਗੀ ਹੈ ਅਤੇ ਨਾ ਹੀ ਲੋਕਾਂ ਨੂੰ ਉੰਨਾਂ ਇੰਟਰਸਟ ਹੈਗਾ ਹੈ ਕਿ ਉਹ ਉਹ ਸਭ ਖਰੀਦਣ ਅਤੇ ਇਹ ਉਹਦੀ ਪ੍ਰਮੁੱਖ ਚੁਣੌਤੀਆਂ ਨੇ ਜਿਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ